ਮੈਨੂੰ ਬਾਹਰ ਜਾਂਦੇ ਹੋਏ ਕਿਤੇ ਵੀ ਵਿਤਕਰੇ ਜਾਂ ਪੱਖਪਾਤ ਦਾ ਕੋਈ ਖਾਸ ਅਨੁਭਵ ਤਾਂ ਨਹੀਂ ਹੋਇਆ ਬਟ ਹਾਂ ਅਸੀਂ ਹਰ ਕਿਤੇ ਜਾਂਦੇ ਹਾਂ ਤਾਂ ਮੇਰੇ ਹਰ ਵਾਰ ਪੱਗ ਬੰਨ੍ਹੀ ਹੁੰਦੀ ਹੈ ਅਤੇ ਪੱਗ ਬੰਨ੍ਹਣ ਕਰਕੇ ਸਾਨੂੰ ਅਲੱਗ ਤੋਂ ਦੇਖਿਆ ਜਾਂਦਾ ਹੈ ਕਿਉਂਕਿ ਸਾਨੂੰ ਸਾਰੇ ਸਰਦਾਰ ਜੀ ਕਹਿ ਕੇ ਬੁਲਾਉਂਦੇ ਹਨ ਅਤੇ ਸਾਡੇ ਗੁਰੂਆਂ ਨੇ ਦਿੱਤੀ ਹੋਈ ਸਾਨੂੰ ਪੱਗ ਜੋ ਕਿ ਸਾਡੇ ਸਿਰ ਦਾ ਤਾਜ ਹੈ ਜੋ ਕਿ ਸਾਨੂੰ ਬਹੁਤ ਜ਼ਿਆਦਾ ਪਿਆਰੀ ਹੈ